ਬਾਈਕਿੰਗ ਨੂੰ ਲੋਕਾਂ ਦੇ ਜਨੂੰਨ ਵਜੋਂ ਪਹੁੰਚਾਉਣ ਲਈ ਮੈਂ ਬਤਾਣਾ ਚਾਹੁੁੰਦਾ ਹਾਂ ਕਿ ਬਾਈਕਿੰਗ ਅੱਜ ਦੇ ਅੱਜ ਦੇ ਯੁੱਗ ਦੇ ਮੁੰਡਿਆਂ ਦੀ ਬਹੁਤ ਵੱਡੀ ਇੱਕ ਪਹਿਚਾਣ ਹੈ ਲੋਕ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਸਪੀਡ ਗਤੀ ਬਹੁਤ ਪਸੰਦ ਹੈ